ਮੋਹਾਲੀ ਜ਼ਿਲ੍ਹੇ ਵਿੱਚ ਅ ਜਿਹੜੀਆਂ ਮੇਨ ਫਸਲਾਂ ਏ ਉਹ ਕਣਕ ਝੋਨਾ ਗੰਨਾ ਇਹ ਜਿਹੜੀਆਂ ਉਗਾਈਆਂ ਜਾਂਦੀਆਂ ਹਨ ਮੇਨ ਤੌਰ 'ਤੇ ਮੁੱਖ ਤੌਰ 'ਤੇ ਅਤੇ ਇਸ ਲੋੜ ਤੋਂ ਵੱਧ ਇਹਨਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਮੰਡੀ ਵਿੱਚ ਵੇਚਿਆ ਜਾਂਦਾ ਏ ਵੇਚਣ ਤੋਂ ਬਾਅਦ ਹੀ ਜੋ ਪੰਜਾਬ ਦੀ ਜਿਹੜੀ ਆਮਦਨ ਵਿੱਚ ਇਹਦੇ 'ਚ ਵਾਧਾ ਹੁੰਦਾ ਏ ਇਸ ਤਰ੍ਹਾਂ ਇਹ ਇਹਦੇ ਵਿੱਚ ਜਿਹੜੀ ਸਥਾਨਿਕ ਆਰਥਿਕਤਾ ਵਿੱਚ ਵੀ ਆਪਣਾ ਯੋਗਦਾਨ ਦਿੰਦੀਆਂ ਹਨ